ਪੰਜਾਬ ਦੇ ਵਿੱਚ ਸਿਹਤ ਨੂੰ ਲੈ ਕੇ ਸਾਡੇ ਬਹੁਤ ਚੁਣੌਤੀਆਂ ਆਉਂਦੀਆਂ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਾਡੇ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਸਿਹਤ ਦੇ ਜਿਹੜੇ ਕੇਂਦਰ ਹੈ ਜੋ ਸਰਕਾ ਸਰਕਾਰੀ ਹਾਊਸ ਹਸਪਤਾਲ ਹੈ ਹੋਸਪਿਟਲ ਹੈ ਉਹਨਾਂ ਦੀਆਂ ਜਿਹੜੀਆਂ ਬਿਲਡਿੰਗਾਂ ਦਾ ਸਟਰਕਚਰ ਹੈ ਬਹੁਤ ਮਾੜਾ ਹੈ ਜਿਹਦੇ ਕਰਕੇ ਕੀ ਹੈ ਵੀ ਲੋਕਾਂ ਦਾ ਸਿਹਤ ਕੇਂਦਰਾਂ ਤੱਕ ਜਾਣਾ ਪਹੁੰਚ ਕਰਨਾ ਅਤੇ ਉੱਥੋਂ ਦੇ ਮਾਹੌਲ ਨੂੰ ਉੱਥੇ ਉੱਥੋਂ ਦੀ ਬਿਲਡਿੰਗਾਂ ਨੂੰ ਦੇਖ ਕੇ ਐਂ ਲੱਗਦਾ ਵੀ ਜਿਵੇਂ ਉੱਥੇ ਕਿਸੇ ਤਰ੍ਹਾਂ ਦੀ ਕੋਈ ਡਾਕਟਰ ਦੀ ਕਿਸੇ ਤਰ੍ਹਾਂ ਦੀ ਕੋਈ ਚਹਿਲ ਪਹਿਲ ਨਹੀਂ ਹੈਗੀ ਇਸ ਤੋਂ ਇਲਾਵਾ ਜਦੋਂ ਕਿਸੇ ਪੇਸ਼ੈਂਟ ਜਾਂ ਮਰੀਜ਼ ਨੂੰ ਹੋਸਪਿਟਲ ਦੇ ਵਿੱਚ ਐਡਮਿਟ ਰੱਖਿਆ ਜਾਂਦਾ ਹੈ ਨਾ ਤਾਂ ਉੱਥੇ ਕਿਸੇ ਪੱਖੇ ਦਾ ਜਾਂ ਕਿਸੇ ਕਿਸੇ ਕੁੱਲਰ ਦਾ ਕੋਈ ਪ੍ਰਬੰਧ ਨਹੀਂ ਦਿੱਤਾ ਜਾਂਦਾ ਜਿਹਦੇ ਕਰਕੇ ਮਰੀਜ਼ ਨੂੰ ਬੜੀ ਸਫੋਕੇਸ਼ਨ ਅਤੇ ਹਵਾ ਨਾ ਹੋਣ ਕਰਕੇ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਈਵਨ ਕਿ ਇੱਥੋਂ ਤੱਕ ਗੱਲ ਹੈਗੀ ਆ ਵੀ ਕਈ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦਾ ਵੀ ਜੋ ਸੀਟਾਂ ਹੈ ਉਹ ਖਾਲੀ ਪਈਆਂ ਹੈ ਜਿਸ ਦੇ ਕਰਕੇ ਜਿਹੜੀ ਸੰਬੰਧਿਤ ਬਿਮਾਰੀ ਨਾਲ ਮਰੀਜ਼ ਨੂੰ ਸਾਹਮਣਾ ਕਰਨਾ ਪੈਂਦਾ ਹੈ ਉਸ ਬਿਮਾਰੀ ਨਾਲ ਸੰਬੰਧਿਤ ਡਾਕਟਰ ਦੇ ਨਾ ਹੋਣ ਕਰਕੇ ਮਰੀਜ਼ ਨੂੰ ਜਿਹੜੇ ਬਾਹਰ ਕੋਈ ਪ੍ਰਾਈਵੇਟ ਹਸਪਤਾਲ ਬਣੇ ਹੈ ਉਹਨਾਂ ਦੇ ਵਿੱਚ ਮਜ਼ਬੂਰੀ ਵਸ ਜਾਣਾ ਪੈਂਦਾ ਹੈ ਮਜਬੂਰੀ ਕਰਕੇ ਉਦੋਂ ਜਿਹੜੀ ਪੈਸਿਆਂ ਦੀ ਲੁੱਟ ਹੈ ਉਹ ਅੰਨ੍ਹੇਵਾਹ ਕੀਤੀ ਜਾਂਦੀ ਹੈ ਜੇ ਸਾਡੇ ਸਰਕਾਰੀ ਹਸਪਤਾਲਾਂ ਦੇ ਸਿਸਟਮ ਢਾਂਚੇ ਨੂੰ ਵਧੀਆ ਤਰੀਕੇ ਨਾਲ ਬਣਾ ਕੇ ਅਤੇ ਉਹਨਾਂ ਦੇ ਵਿੱਚ ਪ੍ਰੋਪਰ ਡਾਕਟਰਾਂ ਦੀ ਭਰਤੀ ਵਗੈਰਾ ਕੀਤੀ ਜਾਵੇ ਜੋ ਤਾਂ ਜੋ ਲੋਕਾਂ ਨੂੰ ਸਿ ਸਿਹਤ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਹੈ ਉਹਨਾਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ ਸਰਕਾਰ ਦੀ ਇੱਕ ਸਕੀਮ ਚੱਲ ਰਹੀ ਹੈ ਜਿਹਦੇ ਤਹਿਤ ਸਰਕਾਰ ਕਹਿੰਦੀ ਹੈ ਵੀ ਹੈ ਹੈਲਥ ਸਿੱਧ ਦਾ ਬੀਮਾ ਕਰਵਾਓ ਅਤੇ ਫਰੀ ਇਲਾਜ ਪਾਓ ਉਹ ਕਾਰਡ ਜਿਹੜੇ ਬਣਾਏ ਜਾਂਦੇ ਹੈ ਉਹ ਕਾਰਡ ਵੀ ਕਿਸੇ ਹੱਦ ਤੱਕ ਹੀ ਚੱਲਦੇ ਹੈ ਕਈਆਂ ਦੇ ਕਾਰਡ ਬਣਦੇ ਨਹੀਂ ਜੇ ਬਣ ਜਾਂਦੇ ਹੈ ਤਾਂ ਚੱਲਦੇ ਨਹੀਂ ਜੇ ਹੋਸਪਿਟਲਾਂ ਦੇ ਵਿੱਚ ਉਹ ਡਾਕਟਰ ਨਾਲ ਕੰਸਰਨ ਕਰਦਾ ਹੈ ਤਾਂ ਡਾਕਟਰ ਕਹਿੰਦੇ ਆ ਵੀ ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈ ਅਸੀਂ ਇਹਦੇ ਵਿੱਚ ਤੁਹਾਡੀ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕਰ ਸਕਦੇ ਤਾਂ ਫਿਰ ਸਾਡੇ ਲੋਕਾਂ ਦੇ ਕੋਲ ਮਜ਼ਬੂਰੀ ਬਸ ਕੋਈ ਹੋਰ ਹੱਲ ਨਹੀਂ ਹੁੰਦਾ ਜਿਹਦੇ ਕਰਕੇ ਉਹਨਾਂ ਨੂੰ ਆਪਣੇ ਇਲਾਜ ਲਈ ਇੱਧਰ ਉੱਧਰ ਜਾਂ ਬਾਹਰ ਜੋ ਪ੍ਰਾਈਵੇਟ ਹਸਪਤਾਲ ਹੈਗੇ ਆ ਉਹਨਾਂ ਦੇ ਵਿੱਚ ਆਪਣਾ ਇਲਾਜ ਕਰਵਾਉਣ ਲਈ ਜਾਣਾ ਪੈਂਦਾ ਹੈ ਨਾ ਹੀ ਸਾਡੇ ਹੋਸਪਿਟਲਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਐਮਰਜੈਂਸੀ ਦੇ ਰਿਗਾਰਡਿੰਗ ਐਂਬੂਲੈਂਸਾਂ ਦਾ ਪ੍ਰਬੰਧ ਹੈ ਵੀ ਜਾਂ ਜੇ ਕਿਸੇ ਕੋਈ ਕਿਤੇ ਕੋਈ ਰੋਡ ਦੇ ਉੱਤੇ ਰੋਡ ਐਕਸੀਡੈਂਟ ਜਾਂ ਅਣਸੁਖਾਵੀ ਘਟਨਾ ਵਾਪਰਦੀ ਹੈ ਐਮੂਲੈਂਸਾਂ ਦਾ ਨਾ ਹੋਣ ਕਰਕੇ ਤਾਂ ਜਦੋਂ ਹੈ ਹੀ ਨਹੀਂ ਤਾਂ ਉੱਥੇ ਪਹੁੰਚਣਗੀਆਂ ਕੀ ਨਾ ਪਹੁੰਚਣ ਕਰਕੇ ਜੋ ਉੱਥੇ ਜਿਹੜੇ ਬੰਦੇ ਨਾਲ ਜਾਂ ਜਿਹੜੇ ਵਿਅਕਤੀ ਨਾਲ ਘਟਨਾ ਵਾਪਰੀ ਹੈ ਉਹਦਾ ਮੌਕੇ 'ਤੇ ਹੀ ਡੈਥ ਦਾ ਹੋ ਜਾਣਾ ਜਾਂ ਉਹਦਾ ਜਿਹੜਾ ਛੋਟੀ ਸੱਟ ਤੋਂ ਵੱਡੀ ਸੱਟ ਦੇ ਵਿੱਚ ਤਬਦੀਲ ਹੋ ਜਾਣਾ ਫਸਟਐਡ ਜਿਹੜੀ ਲੋਕਾਂ ਦੁਆਰਾ ਹੀ ਉਹਨੂੰ ਦੇ ਕੇ ਫਿਰ ਉਸ ਸਰਕਾਰੀ ਹੋਸਪੀਟਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਹੈ ਜਾਂਦਾ ਜਿੱਥੇ ਕਿ ਡਾਕਟਰਾਂ ਦੀ ਅਵੇਲੇਬਿਲਿਟੀ ਨਾ ਹੋਣ ਕਰਕੇ ਡਾਕਟਰਾਂ ਦੇ ਹਾਜ਼ਰ ਨਾ ਹੋਣ ਕਰਕੇ ਉਸ ਮਰੀਜ਼ ਨੂੰ ਕਾਫ਼ੀ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਔਰ ਦਰਦ ਨਾਲ ਤਰਾਹੀ ਤਰਾਹੀ ਕਰਦਾ ਹੋਇਆ ਹਾਰ ਕੇ ਲੋਕਾਂ ਨੂੰ ਕਹਿੰਦਾ ਵੀ ਮੈਨੂੰ ਇੱਥੋਂ ਕੱਢ ਕੇ ਕਿਸੇ ਹੋਰ ਪ੍ਰਾਈਵੇਟ ਸਰਕਾਰੀ ਹੋਸਪਿਟਲ 'ਚੋਂ ਕੱਢ ਕੇ ਕਿਸੇ ਹੋਰ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੈ ਜਾਓ ਤਾਂ ਜੋ ਜਿਹੜੀ ਮੇਰੀ ਜਾਨ ਹੈ ਉਹ ਸੌਖੀ ਹੋ ਸਕੇ